ਭੰਗੜਾ ਏਅਰੋਬਿਕਸ ਵਿੱਚ ਭਾਗ ਲੈਣਾ ਮੇਰਾ ਸ਼ੁਰੂ ਤੋਂ ਹੀ ਸਪਨਾ ਰਿਹਾ ਹੈ ਪਰ ਸਰੀਰਿਕ ਤੌਰ 'ਤੇ ਠੀਕ ਨਾ ਹੋਣ ਕਰਕੇ ਮੈਂ ਭੰਗੜਾ ਏਅਰੋਬਿਕਸ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ ਪਰ ਇਸ ਨੂੰ ਦੇਖਣ ਦੇ ਨਾਲ ਹੀ ਮੇਰੇ ਮਨ ਦੇ ਵਿੱਚ ਇੱਕ ਬੜੀ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਮਾਨਸਿਕ ਤੌਰ 'ਤੇ ਭੰਗੜੇ ਨੂੰ ਦੇਖ ਕੇ ਅਤੇ ਗਾਣੇ ਸੁਣ ਕੇ ਮੇਰਾ ਮਨ ਪੂਰੀ ਤਰ੍ਹਾਂ ਖਿੱਲ ਉੱਠਦਾ ਹੈ ਮੈਨੂੰ ਇੰਝ ਲੱਗਦਾ ਹੀ ਨਹੀਂ ਕਿ ਮੈਂ ਇਸ ਦੁਨੀਆਂ 'ਤੇ ਹਾਂ ਮੈਂ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਇੱਕ ਅਲੱਗ ਦੁਨੀਆਂ ਦੇ ਵਿੱਚ ਮਹਿਸੂਸ ਕਰਦੀ ਹਾਂ ਜਿੱਥੇ ਨਾ ਤਾਂ ਮੈਨੂੰ ਕੋਈ ਟੈਨਸ਼ਨ ਹੁੰਦੀ ਹੈ ਅਤੇ ਨਾ ਹੀ ਮੈਨੂੰ ਕੋਈ ਸਿਰਦਰਦੀ ਮੈਂ ਆਪਣੇ ਸਾਰੇ ਕੰਮਾਂ ਨੂੰ ਭੁੱਲ ਜਾਂਦੀ ਹਾਂ ਬਸ ਭੰਗੜੇ ਦੇ ਵਿੱਚ ਹੀ ਖੋ ਜਾਂਦੀ ਹਾਂ ਹਾਲਾਂਕਿ ਮੈਂ ਭੰਗੜਾ ਨਹੀਂ ਕਰ ਸਕਦੀ ਪਰ ਮੈਂ ਆਪਣੇ ਆਪ ਨੂੰ ਭੰਗੜੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਰੁਝਾਅ ਲੈਂਦੀ ਹਾਂ ਉਹ ਮੇਰਾ ਸ ਭੰਗੜਾ ਸਰੀਰਿਕ ਤੌਰ 'ਤੇ ਨਾ ਹੋ ਨਾ ਨਹੀਂ ਹੁੰਦਾ ਬਲਕਿ ਮੈਂ ਮਾਨਸ ਮਾਨਸਿਕ ਤੌਰ 'ਤੇ ਆਪਣੇ ਆਪਣੇ ਸਰੀਰ ਨਾਲ ਭੰਗੜਾ ਕਰਦੀ ਹਾਂ